ਹਾਂਜੀ ਮੈਂ ਨਾ ਪਿੱਛੇ ਬੈਠੀ ਆ ਅਤੇ ਮੇਰੇ ਨਾਲ ਸੀਟ 'ਤੇ ਮੈਨੂੰ ਬਹੁਤ ਦਿੱਕਤ ਆ ਰਹੀ ਆ ਬਸ 'ਚ ਮੇਰੀ ਸੀਟ ਮੇਰੀ ਸੀਟ ਬਦਲੋ ਹਾਂਜੀ ਮੇਰੀ ਸੀਟ ਬਦਲੋ ਮੈਨੂੰ ਬਹੁਤ ਦਿੱਕਤ ਆਈ ਜਾਂਦੀ ਹੈ ਮੇਰੇ ਪਹਿਲਾਂ ਹੀ ਦਰਦ ਹੋਈ ਜਾਂਦਾ ਅਤੇ ਮੇਰੀ ਪਲੀਜ਼ ਤੁਸੀਂ ਸੀਟ ਨਾ ਚੇਂਜ ਕਰੋ ਮੈਂ ਬਹਿ ਨਹੀਂ ਸਕਦੀ ਪਿੱਛੇ ਮੈਂ ਤੁਹਾਡੇ ਪਰੇਸ਼ਾਨੀ ਦਾ ਮੈਨੂੰ ਨਹੀਂ ਪਤਾ ਅਤੇ ਮੇਰਾ ਹੱਲ ਕਰੋ ਮੈਂ ਬੱਸ ਚੋਂ ਨਹੀਂ ਤਾਂ ਉਤਰਨ ਲੱਗੀ ਆ ਮੇਰੀ ਸੀਟ ਬਦਲੋ ਮੇਰੀ

ਮੈਨੂੰ ਬਹੁਤ ਪਰੇਸ਼ਾਨੀ ਹੋਈ ਜਾਂਦੀ ਹੈ ਮੇਰੇ ਤੋਂ ਨਹੀਂ ਬੈਠਾ ਜਾਂਦਾ ਮੈਂ ਬੜੀ ਤੰਗ ਆ ਬੈਠੀ ਕੋਈ ਕੋਈ ਨਾ ਕੋਈ ਤਾਂ ਹੱਲ ਹੋ ਹੀ ਸਕਦਾ ਨਹੀਂ ਕਿਸੇ ਨੂੰ ਤੁਸੀਂ ਉਠਾ ਕੇ ਕਿਸੇ ਨੌਜਵਾਨ ਨੂੰ ਤੁਸੀਂ ਪਿੱਛੇ ਕਰ ਦਿਓ ਅਤੇ ਮੈਨੂੰ ਅੱਗੇ ਕਰ ਲਓ ਨਹੀਂ ਕਿਸੇ ਨੂੰ ਉਠਾਓ ਨਾ ਅੱਛਾ ਮੈਂ ਫਿਰ ਕੀ ਕਰਾਂ ਮੈਨੂੰ ਤਾਂ ਆਪ ਬਹੁਤ ਦਿੱਕਤ ਆਈ ਜਾਂਦੀ ਹੈ ਅਤੇ ਖੜ੍ਹੇ ਮੇਰੇ ਤੋਂ ਖੜ੍ਹਾ ਵੀ ਨਹੀਂ ਜਾਂਦਾ ਮੇਰੇ ਤੋਂ ਬੈਠਾ ਵੀ ਨਹੀਂ ਜਾਂਦਾ ਨਹੀਂ ਫਿਰ ਮੈਨੂੰ ਨਾ ਅੱਗੇ ਕਰੋ ਤੁਸੀਂ ਇਹ ਗੱਲ ਨਹੀਂ ਤੁਹਾਡੀ ਚੰਗੀ ਨਹੀਂ ਨਹੀਂ ਮੈਂ ਅੱਗੇ ਮੈਨੂੰ ਤਾਂ ਅੱਗੇ ਲੈ ਕੇ ਜਾਓ ਕਿਸੇ ਨਾਲ ਮੇਰੀ ਨਾ ਸੀਟ ਬਦਲੋ ਮੈਨੂੰ ਮੈਂ ਅੱਗੇ ਕਿਧਰ ਦੀ ਆਵਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ

ਨਹੀਂ ਮੇਰੀ ਤਾਂ ਸੀਟ ਨਾ ਮੇਰੀ ਸੀਟ ਬਦਲੋ ਨਹੀਂ ਤੁਸੀਂ ਮੇਰੀ ਜਿਵੇਂ ਕਿਵੇਂ ਨਾ ਕਿਵੇਂ ਬਦਲੋ ਸੀਟ ਅਤੇ ਮੈਂ ਅੱਗੇ ਆ ਰਹੀ ਆ